ਹਾਂਜੀ ਉਹ ਬੱਚੇ ਆਪਣੇ ਇੰਡੀਆ ਤੋਂ ਬਾਹਰ ਪੜ੍ਹਨ ਜਾਣਾ ਚਾਹੁੰਦੇ ਹੈ ਅਲੱਗ ਅਲੱਗ ਤਰ੍ਹਾਂ ਦੀਆਂ ਫੈਸਿਲਿਟੀਆਂ ਅਵੇਲੇਬਲ ਹੈ ਔਰ ਇਹਦੇ ਵਿੱਚ ਅਸੀਂ ਜਿਸ ਤਰ੍ਹਾਂ ਆਪਣੀਆਂ ਇੱਥੇ ਦੀਆਂ ਯੂਨੀਵਰਸਿਟੀਆਂ ਦਾ ਐਕਸਚੇਂਜ ਪ੍ਰੋਗਰਾਮ ਚਲਾਉਂਦੀਆਂ ਬਾਹਰ ਦੀਆਂ ਯੂਨੀਵਰਸਿਟੀਆਂ ਦੇ ਨਾਲ ਉਹਨਾਂ ਦਾ ਟਾਏ ਅਪ ਹੁੰਦੇ ਹੈ ਐੱਮ ਓ ਜ਼ੂ ਯੂ ਵਗੈਰਾ ਉਹਨਾਂ ਦੇ ਪ੍ਰੋਗਰਾਮ ਸੈੱਟ ਹੁੰਦੇ ਆ ਅਤੇ ਫਿਰ ਇੱਕ ਹੁੰਦਾ ਕਿ ਸਕੋਲਰਸ਼ਿਪ ਪ੍ਰੋਗਰਾਮਸ ਵੀ ਹੁੰਦੇ ਆ ਜਿਹਦੇ ਵਿੱਚ ਬੱਚਿਆਂ ਨੂੰ ਕਾਫੀ ਜਿਹੜੇ ਫਾਈਨੈਂਸ਼ਅਲੀ ਨਹੀਂ ਕਰ ਪਾਉਂਦੇ ਆਪਣੇ ਆਪ ਨੂੰ ਉਹ ਸਕੋਲਰਸ਼ਿਪ ਦਾ ਫੈਸਿਲਿਟੀ ਉਹਨਾਂ ਵਾਸਤੇ ਅਵੇਲੇਬਲ ਹੈ ਇਸ ਪ੍ਰੋਗਰਾਮ ਦੇ ਅੰਡਰ ਜਾ ਸਕਦੇ ਹੈ ਅਤੇ ਫਿਰ ਬਾਕੀ ਇਹ ਹੈ ਕਿ ਜਿਹੜੇ ਟੈਸਟ ਵਗੈਰਾ ਆਈਲੈਟਸ ਵਗੈਰਾ ਕਰਕੇ ਜਾਂ ਦੂਸਰੇ ਹੋਰ ਕੁਛ ਅਵੇਲੇਬਲ ਹੈਗੇ ਟੈਸਟ ਉਹ ਸਰੀ ਐਗਜ਼ੈਮਜ਼ ਪਾਸ ਕਰਕੇ ਉਹ ਅਪ ਲਗਾ ਸਕਦੇ ਆਪਣੀ ਫਾਈਲ